ਮੇਰੇ ਕਜ਼ਨਸ ਮੋਸਟਲੀ ਬਾਹਰ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਤਾਂ ਉਹ ਅਕਸਰ ਜਦੋਂ ਵੀ ਪੰਜਾਬ ਵਿਜ਼ਿਟ ਕਰਦੇ ਨੇ ਤਾਂ ਫਸਟ ਆੱਫ ਆਲ ਤਾਂ ਅਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਜਾਂਦੇ ਹਾਂ ਨਮਸਤਕ ਹੁੰਦੇ ਹਾਂ ਤਾਂ ਉਸ ਤੋਂ ਬਾਅਦ ਜੇਕਰ ਅਸੀਂ ਹੋਰ ਵੀ ਕਿਤੇ ਘੁੰਮਣਾ ਹੋਵੇ ਤਾਂ ਅਸੀਂ ਯੂਨੀਵਰਸਿਟੀਜ਼ ਦੇਖਦੇ ਨੇ ਉਹਨਾਂ ਨੇ ਮਤਲਬ ਮੇਰੀ ਪੰਜਾਬੀ ਯੂਨੀਵਰਸਿਟੀ ਖ਼ਾਸ ਕਰ ਉਹਨਾਂ ਨੇ ਦੇਖੀ ਹੋਈ ਹੈ ਇਸ ਤੋਂ ਬਿਨਾਂ ਤਾਜ ਮਹਿਲ ਦੇਖਣ ਦੇ ਲਈ ਆਗਰੇ ਗਏ ਹਾਂ ਮਨਾਲੀ ਕੁੱਲੂ ਕਸ਼ਮੀਰ ਹਿਮਾਚਲ ਪ੍ਰਦੇਸ਼ ਇੱਥੋਂ ਸਾਰੋ ਦੇ ਵਧੀਆ ਪਹਾੜ ਗਰੀਨਰੀ ਇੱਥੋਂ ਦਾ ਮੌਸਮ ਠੀਕ ਹੈ ਇਹ ਸਾਰਾ ਕੁਛ ਦੇਖ ਕੇ ਉਹ ਵੀ ਬਹੁਤ ਖੁਸ਼ ਹੁੰਦੇ ਨੇ ਅਤੇ ਮੈਨੂੰ ਵੀ ਬਹੁਤ ਵਧੀਆ ਲੱਗਦਾ ਹੈ ਤਾਂ ਮੈਂ ਆਪਣੇ ਮਹਿਮਾਨਾਂ ਨੂੰ ਇੱਥੇ ਸਾਰੇ ਕਿਤੇ ਲਿਜਾਣਾ ਪਸੰਦ ਕਰਦੀ ਹਾਂ